ਹਾਂਜੀ ਹਾਂਜੀ ਹਾਂਜੀ ਬੋਲੋ ਜੀ ਓਕੇ ਅੱਛਾ ਜੀ ਅੱਛਾ ਹਾਂਜੀ ਤੁਸੀਂ ਤੁਸੀਂ ਸਜਾਵਟ ਵਾਸਤੇ ਤੁਹਾਨੂੰ ਚਾਹੀਦੇ ਤੁਸੀਂ ਘਰ ਦੇ ਘਰੇ ਹੀ ਕਰਨੀ ਆ ਠੀਕ ਹ ਜੀ ਸਜਾਵਟ ਠੀਕ ਹ ਜੀ ਤੁਸੀਂ ਕਲਰ ਫੁੱਲ ਲਉਗੇ ਜਿਵੇਂ ਗੁਲਾਬ ਹੋ ਗਿਆ ਗੇਂਦਾ ਹੋ ਗਿਆ ਪਿੰਕ ਗੁਲਾਬ ਹੋ ਗਿਆ ਰੈਡ ਗੁਲਾਬ ਹੋ ਗਿਆ ਵਾਈਟ ਗੁਲਾਬ ਹੋ ਗਿਆ ਤੇ ਇਸ ਤਰੀਕੇ ਤੁਸੀਂ ਇਹ ਫੁੱਲਾਂ ਦੀ ਚੋਣ ਕਰ ਸਕਦੇ ਤੇ ਬਾਕੀ ਤੁਹਾਡੇ ਕਿੰਨਾ ਕੁ ਘਰ ਕਿੱਡਾ ਕੁ ਵੱਡਾ ਵਾ ਉਸਦਾ ਹਿਸਾਬ ਕਿਤਾਬ ਸਾਨੂੰ ਲਾ ਕੇ ਦੱਸ ਦਿਓ ਓਕੇ ਉਹਨਾਂ ਦੀਆਂ ਮਾਲਾਵਾਂ ਬਣਾ ਕੇ ਲਗਾਈਆਂ ਜਾਣਗੀਆਂ ਬਾਕੀ ਸਾਡੇ ਤੁਹਾਨੂੰ ਬੰਦੇ ਭੇਜਾਂਗੇ ਅਸੀਂ ਇੱਕ ਇੱਕ ਨਾਲ ਬੰਦਾ ਭੇਜਾਂਗੇ ਉਹ ਆਪ ਹੀ ਸਾਰਾ ਕੁਝ ਤੁਹਾਡੇ ਅਰੇਂਜਮੈਂਟ ਕਰ ਦੇਗਾ ਸਜਾਵਟ ਕਰੇਗਾ ਉਹ ਆਪ ਖੁਦ ਹੀ ਤੇ ਉਹਦਾ ਐਕਸਟਰਾ ਤੁਹਾਨੂੰ ਅਸੀਂ ਉਹਦੇ ਤੁਹਾਨੂੰ ਦੇਣਾ ਪਊਗਾ ਪੇਮੈਂਟ ਕਰਨੀ ਪਊਗੀ ਹਾਂਜੀ ਹੋਰ ਹਾਂਜੀ ਹਾਂਜੀ ਭਵਾਂ ਤੁਸੀਂ ਉਸ ਤੋਂ ਪਹਿਲਾਂ ਕਹੋ ਦੱਸੋ ਕਦੋਂ ਤੁਸੀਂ ਕਹੋਗੇ ਜਦੋਂ ਤੁਸੀਂ ਆਰਡਰ ਦੇਓਗੇ ਤੁਹਾਨੂੰ ਉਦੋਂ ਹੀ ਉਹ ਪ੍ਰੋਵਾਈਡ ਕਰਾਇਆ ਜਾਊਗਾ ਸਾਰਾ ਕੁਛ

ਹਾਂਜੀ ਅੱਧੀ ਪੇਮੈਂਟ ਤੁਹਾਨੂੰ ਪਹਿਲਾਂ ਕਰਵਾਉਣੀ ਪਊਗੀ ਅੱਧੀ ਤੁਸੀਂ ਬਾਅਦ ਚ ਕਰੋਗੇ ਜਦੋਂ ਅਸੀਂ ਸਾਰੀ ਕਰਕੇ ਜਾਵਾਂਗੇ ਨਾ ਤੁਹਾਡੇ ਸਜਾਵਟ ਕਰਕੇ ਜਾਣਗੇ ਤੇ ਅੱਧੀ ਫੇਰ ਤੁਹਾਨੂੰ ਪੇਮੈਂਟ ਕਰਨੀ ਪਊਗੀ ਉਸੇ ਦਿਨ ਹੀ ਉਹ ਤਾਂ ਤੁਸੀਂ ਇਲੈਕਟਰੋਨਿਕ ਤੋਂ ਫਿਰ ਲੜੀਆਂ ਦਾ ਤੁਸੀਂ ਲਾਈਟਿੰਗ ਦਾ ਤਾਂ ਕਰਵਾ ਸਕਦੇ ਆ ਸਾਡੇ ਕੋਲ ਤਾਂ ਫੁੱਲਾਂ ਦਾ ਹੀ ਹੁੰਦਾ ਜੀ ਫੁੱਲਾਂ ਦੇ ਹੀ ਅਸੀਂ ਤਾਂ ਸਾਡਾ ਉਹ ਆਊਗਾ ਜਿਹੜਾ ਤੁਹਾਡਾ ਸਾਡਾ ਬੰਦਾ ਤੇ ਉਹ ਤੁਹਾਨੂੰ ਆਪ ਹੀ ਸਾਰੇ ਸਜਾਵਟ ਕਰਕੇ ਜਾਊਗਾ ਤੁਹਾਨੂੰ ਕੋਈ ਵੀ ਸਿਰ ਦਰਦੀ ਲੈਣ ਦੀ ਜਰੂਰਤ ਨਹੀਂ ਤੇ ਕੁਆਂਟਿਟੀ ਵੀ ਉਹ ਆਪ ਹੀ ਕੋਈ ਗੱਲ ਡਿਸਾਈਡ ਕਰ ਲੂਗਾ ਜਦੋਂ ਤੁਸੀਂ ਸਾਨੂੰ ਸਾਰੀ ਜਗਹਾ ਦਾ ਐਸਟੀਮੇਟ ਲਾ ਕੇ ਦੇ ਦੋਗੇ ਹਾਂਜੀ ਹੋਰ ਨਹੀਂ ਨਹੀਂ ਹੋ ਜੂ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਵਧੀਆ ਤਰੀਕੇ ਨਾਲ ਵਧੀਆ ਸਹੀ ਤਰੀਕੇ ਨਾਲ ਅੱਗੇ ਵੀ ਅਸੀਂ ਤੁਹਾਡੇ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਹਾਂਜੀ ਹਾਂਜੀ ਬਸ ਉਥੇ ਤਾਂ ਪਹਿਲਾਂ ਵੀ ਅਸੀਂ ਕਰਕੇ ਆਏ ਹੋਏ ਆਂ ਬਹੁਤ ਵਾਰੀ ਇਹ ਸਜਾਵਟ ਸਾਡੇ ਬੰਦੇ ਗਏ ਨੇ ਸਾਡੇ ਸ਼ੋਪ ਤੋਂ ਹੀ ਫੁੱਲ ਜਾਂਦੇ ਆ ਹਰੇਕ ਥਾਂ ਇਥੇ ਨੇੜੇ ਨੇੜੇ ਅਸੀਂ ਸਾਰੇ ਕਰਦੇ ਆ ਕੋਈ ਗੱਲ ਨਹੀਂ ਜਿਹੋ ਜਿਹੇ ਵੀ ਤੁਸੀਂ ਕਹੋਗੇ ਹਾਂਜੀ ਹਾਂਜੀ ਹੁਣ ਵੇਖੋ ਮੈਰਿਜ ਦਾ ਕੰਮ ਹੈ ਇਹਦੇ ਵਿੱਚ ਤਾਂ ਤੁਸੀਂ ਗੂੜੇ ਗੂੜੇ ਰੰਗ ਸੋਹਣੇ ਸੋਹਣੇ ਗੁਲਾਬੀ ਪਿੰਕ ਵਾਈਟ ਸਾਰੇ ਫੁੱਲ ਰਲ ਕੇ ਹੀ ਤੁਹਾਡੇ ਸਜਾਵਟ ਵਧੀਆ ਬਣਨੀ ਐ ਹਾਂਜੀ ਓਕੇ ਜੀ ਓਕੇ ਓਕੇ